ਮੈਂ ਮੀਸ਼ੂ ਕੰਪਨੀ ਤੋਂ ਔਨਲਾਈਨ ਸ਼ੋਪਿੰਗ ਕੀਤੀ ਸੀ ਉਸ ਵਿੱਚ ਮੈਂ ਕਿਚਨ ਲਈ ਪਲਾਸਟਿਕ ਦੇ ਡੱਬੇ ਮੰਗਵਾਏ ਸੀ ਪਹਿਲਾਂ ਤਾਂ ਉਹ ਇਹਨਾਂ ਦੀ ਡਿਲੀਵਰੀ ਬਹੁਤ ਜ਼ਿਆਦਾ ਲੇਟ ਪਹੁੰਚੀ ਇਹਨਾਂ ਲਈ ਮੈਂ ਬਹੁਤ ਜ਼ਿਆਦਾ ਐਕਸਾਈਟ ਸੀ ਮੈਨੂੰ ਇਹਨਾਂ ਦੀ ਉਸ ਟਾਈਮ ਬਹੁਤ ਜ਼ਿਆਦਾ ਲੋੜ ਸੀ ਪਰ ਮੇਰੇ ਕੋਲ ਇਹ ਉਸ ਟਾਈਮ ਨਹੀਂ ਪਹੁੰਚੇ ਅਤੇ ਟਾਈਮ ਤੋਂ ਬਾਅਦ ਪਹੁੰਚੇ ਜਦੋਂ ਮੈਂ ਇਹਨਾਂ ਨੂੰ ਅਨਬੋਕਸ ਕੀਤਾ ਤਾਂ ਇਹਨਾਂ ਵਿੱਚੋਂ ਡੱਬੇ ਟੁੱਟੇ ਹੋਏ ਸਨ ਅਤੇ ਇਹਨਾਂ ਦਾ ਜਿਹੜਾ ਉਹ ਮਟੀਰੀਅਲ ਸੀ ਬਹੁਤ ਜ਼ਿਆਦਾ ਪਲਾਸ ਮਟੀਰੀਅਲ ਬਹੁਤ ਜ਼ਿਆਦਾ ਘਟੀਆ ਸੀ ਜੋ ਮੈਂ ਉਸ ਵਿੱਚ ਦੇਖ ਕੇ ਔਡਰ ਕੀਤਾ ਸੀ ਇਹਨਾਂ ਦੀ ਕੁਆਲਿਟੀ ਚੈੱਕ ਕਰਕੇ ਉਨ ਉਹ ਮੰਗਵਾਇਆ ਸੀ ਪਰ ਮੈਨੂੰ ਉਹ ਚੀਜ਼ ਨਹੀਂ ਮਿਲੀ ਇਹ ਟੁੱਟੇ ਹੋਏ ਸਨ ਅਤੇ ਇਹਨਾਂ ਦਾ ਮਟੀਰੀਅਲ ਬਹੁਤ ਜ਼ਿਆਦਾ ਘਟੀਆ ਲੱਗਿਆ ਹੋਇਆ ਸੀ ਅਤੇ